ਮਧੂ ਮੱਖੀ ਦੇ ਕੱਟਣ ਨਾਲ ਇਸ ਦੇ ਡੰਗ ਤੋਂ ਬਚਣ ਲਈ ਕਈ ਸਾਰੇ ਘਰੇਲੂ ਉਪਚਾਰ ਹਨ ਜਿਵੇਂ ਕਿ ਘਰ ਵਿੱਚ ਵਰਤ ਰਹੇ ਕਈ ਸਾਰੇ ਇਸਤੇਮਾਲ ਆਪਣੇ ਰਸੋਈ ਵਿੱਚ ਕਰ ਰਹੇ ਚੀਜ਼ਾਂ ਦੀ ਵਰਤੋਂ ਨਾਲ ਅਸੀਂ ਇਸ ਦੇ ਡੰਗ ਨੂੰ ਦੂਰ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਜਿਵੇਂ ਕਿ ਬਰਫ਼ ਬਰਫ਼ ਦਾ ਇਸਤੇਮਾਲ ਕਰ ਸਕਦੇ ਹਾਂ ਬਰਫ਼ ਦੇ ਇਸਤੇਮਾਲ ਕਰਨ ਨਾਲ ਇਸ ਦਾ ਦਰਦ ਦੂਰ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਅਸੀਂ ਸ਼ਹਿਦ ਦਾ ਇਸਤੇਮਾਲ ਵੀ ਕਰ ਸਕਦੇ ਹਾਂ ਅਸੀਂ ਰਸੋਈ ਘਰ ਵਿੱਚ ਵਰਤੀਆਂ ਹੋਈਆਂ ਕਈ ਚੀਜ਼ਾਂ ਨਾਲ ਇਸ ਦੇ ਡੰਗ ਨੂੰ ਦੂਰ ਕਰ ਸਕਦੇ ਹਾਂ ਜਿਵੇਂ ਕਿ ਬੇਕਿੰਗ ਸੋਡਾ ਬੇਕਿੰਗ ਸੋਡੇ ਦੇ ਇਸਤੇਮਾਲ ਨਾਲ ਅਸੀਂ ਮਧੂ ਮੱਖੀ ਦੇ ਡੰਗ ਨਾਲ ਜੋ ਦਰਦ ਸੋਜ ਅਤੇ ਖੁਰਕ ਹੁੰਦੀ ਹੈ ਉਸ ਨੂੰ ਦੂਰ ਕੀਤਾ ਜਾ ਸਕਦਾ ਇਸ ਦੇ ਨਾਲ ਹੀ ਜੋ ਕਿ ਖਾਣ ਵਾਲਾ ਸੇਬ ਹੁੰਦਾ ਹੈ ਉਸ ਦੇ ਸਿਰਕੇ ਦਾ ਇਸਤੇਮਾਲ ਕਰਨ ਨਾਲ ਉਸ ਦੇ ਡੰਗ ਦੇ ਜਹਿਰ ਨੂੰ ਦੂਰ ਕੀਤਾ ਜਾ ਸਕਦਾ ਹੈ ਇਸ ਦੇ ਨਾਲ ਹੀ ਘਰ ਵਿੱਚ ਵਰਤੀ ਜਾਂਦੀ ਟੂਥ ਪੇਸਟ ਦੀ ਵਰਤੋਂ ਨਾਲ ਇਸ ਦਾ ਡੰਗ ਵੀ ਦੂਰ ਕੀਤਾ ਜਾ ਸਕਦਾ ਹੈ ਅਸੀਂ ਘਰ ਵਿੱਚ ਵਰਤ ਰਹੇ ਕਈ ਸਾਰੇ ਘਰੇਲੂ ਉਪਚਾਰ ਨਾਲ ਇਸ ਦੇ ਡੰਗ ਨੂੰ ਦੂਰ ਕਰ ਸਕਦੇ ਹਾਂ